ਗੱਲ ਕਰੀ ਜਾਵੇ ਖੇਡਾਂ ਦੀ ਤਾਂ ਮੈਂ ਸਾਰੀਆਂ ਖੇਡਾਂ ਹੀ ਖੇਡ ਲੈਂਦਾ ਹਾਂ ਜਿਵੇਂ ਕੀ ਬਾਸਕਿਟਬੋਲ ਵੋਲੀਬੋਲ ਕ੍ਰਿਕਟ ਫੁੱਟਬਾਲ ਅਤੇ ਟੇਬਲ ਟੇਨਿਸ ਵੀ ਖੇਡ ਲੈਂਦਾ ਹਾਂ ਪਰ ਮੈਨੂੰ ਕ੍ਰਿਕਟ ਨਾਲ ਬਹੁਤ ਹੀ ਪਿਆਰ ਹੈ ਮੈਂ ਸ਼ੁਰੂ ਤੋਂ ਹੀ ਛੋਟੇ ਹੁੰਦੇ ਤੋਂ ਕ੍ਰਿਕਟ ਨਾਲ ਬਹੁਤ ਲਗਾਵ ਰੱਖਦਾ ਹਾਂ ਮੇਰੇ ਪਿਤਾ ਜੀ ਨੇ ਮੈਨੂੰ ਦੋ ਤਿੰਨ ਤਰ੍ਹਾਂ ਦੇ ਬੈਟ ਲਿਆਂਦੇ ਵੇ ਸੀ ਅਤੇ ਮੈਂ ਘਰ ਹੀ ਪ੍ਰੈਕਟਿਸ ਕਰਦਾ ਸੀ ਅਤੇ ਇੱਕ ਦ੍ਰਿਸ਼ ਮੈਂ ਜੋ ਕਿ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ ਜਦੋਂ ਮੈਂ ਦਸਵੀਂ ਕਲਾਸ 'ਚ ਸੀ ਅਤੇ ਮੈਂ ਆਪਣੇ ਸਕੂਲ ਦੇ ਵਿੱਦਿਆਰਥੀਆਂ ਨਾਲ ਆਪਣੇ ਸਕੂਲ ਦੇ ਗਰਾਊਂਡ ਵਿੱਚ ਇੱਕ ਟੂਰਨਾਮੈਂਟ ਖੇਡਿਆ ਸੀ ਉਸ ਬੈਚ ਵਿੱਚ ਮੈਂ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਪੰਜਾਹ ਦੌੜਾਂ ਬਣਾਈਆਂ ਸੀ ਅਤੇ ਤਿੰਨ ਵਿਕਟਾਂ ਵੀ ਲਈਆਂ ਸੀ ਅਤੇ ਜਿਸ ਵਿੱ ਜਿਸ ਕਾਰਨ ਮੈਨੂੰ ਟੂਰਨਾਮੈਂਟ ਵਿੱਚ ਮੈਨ ਔਫ ਦਾ ਮੈਚ ਵੀ ਦਿੱਤਾ ਗਿਆ ਸੀ ਅਤੇ ਉਹ ਮੈਚ ਮੇਰੇ ਲਈ ਬਹੁਤ ਹੀ ਯਾਦਗਾਰੀ ਸੀ ਕਿਉਂਕਿ ਜਦੋਂ ਮੈਂ ਆਪਣੀ ਟੀਮ ਵਾਸਤੇ ਪੰਜਾਹ ਦੌੜਾਂ ਬਣਈਆਂ ਅਤੇ ਮੈਂ ਹਾਈਐਸਟ ਸਕੌਰ ਕੀਤਾ ਸੀ ਅਤੇ ਮੈਨੂੰ ਉਸ ਵੇਲੇ ਮੇਰੇ ਟੀਚਰਾਂ ਵੱਲੋਂ ਵੀ ਬਹੁਤ ਹੀ ਪ੍ਰਸ਼ੰਸਾ ਮਿਲੀ ਸੀ ਅਤੇ ਉਨ੍ਹਾਂ ਨੇ ਮੈਨੂੰ ਆਪਣੀ ਸਕੂਲ ਦੀ ਜੋ ਕ੍ਰਿਕਟ ਟੀਮ ਸੀ ਉਸ ਵਿੱਚ ਸਿਲੈਕਟ ਵੀ ਕਰ ਲਿਆ ਤਾਂ ਜੋ ਮੈਂ ਆਪਣੇ ਸਕੂਲ ਨੂੰ ਉੱਚ ਪੱਧਰ 'ਤੇ ਪ੍ਰਸ ਅਵ ਉੱਚ ਪੱਧਰ 'ਤੇ ਉਨ੍ਹਾਂ ਦੀ ਸਕੂਲ ਦੀ ਟੀਮ ਨੂੰ ਰੀਪ੍ਰਜੈਂਟ ਕਰ ਸਕਾਂ ਅਤੇ ਆਪਣੇ ਆਪ ਨੂੰ ਮੈਂ ਉਸ ਲੈਵਲ ਤੱਕ ਪਹੁੰਚਾ ਸਕਾਂ ਤਾਂ ਜੋ ਮੈਂ ਆਪਣੇ ਇਸ ਕਰੀਅਰ ਨੂੰ ਅੱਗੇ ਦੁਹਰਾ ਸਕਦਾ ਸੀ ਅਤੇ ਉਹ ਮੈਚ ਅੱਜ ਵੀ ਮੈਨੂੰ ਯਾਦਗਾਰ ਹੈ ਜਦੋਂ ਸਾਰੀ ਟੀਮ ਨੇ ਮੈਨੂੰ ਆਪਣੇ ਮੋਢਿਆਂ 'ਤੇ ਚੱਕ ਲਿਆ ਸੀ ਕਿਉਂਕਿ ਮੈਂ ਹੀ ਸੀ ਜੋ ਉਸ ਮੈਚ ਨੂੰ ਬਚਾ ਸਕਿਆ ਸੀ ਅਤੇ ਅੱਗੇ ਆਪਣੇ ਟੂਰਨਾਮੈਂਟ ਵਿੱਚ ਆਪਣੀ ਟੀਮ ਨੂੰ ਲੈ ਕੇ ਗਿਆ ਅਤੇ ਇਹ ਸੀ ਜੋ ਮੇਰਾ ਬਹੁਤ ਹੀ ਯਾਦਗਾਰੀ ਮੈਚ ਸੀ ਅਤੇ ਅੱਜ ਵੀ ਮੈਂ ਉਸਨੂੰ ਯਾਦ ਕਰ ਲੈਂਦਾ ਹਾਂ